ਮੈਂ ਰਜੇਸ਼ ਕੁਮਾਰ ਹਾਂ ਮੇਰਾ ਪਿੰਡ ਫਿਰੋਜ਼ਪੁਰ ਕਲਾਂ ਪਠਾਨਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਮੈਂ ਕਾਫੀ ਸਮਾਨ ਔਨਲਾਈਨ ਮੰਗਵਾਉਂਦਾ ਹਾਂ ਪਿਛਲੇ ਹਫਤੇ ਮੈਂ ਇੱਕ ਰਿਮੋਟ ਦਾ ਆਰਡਰ ਕੀਤਾ ਉਹ ਰਿਮੋਟ ਮੈਂ ਉਡੀਕਦਿਆਂ ਉਡੀਕਦਿਆਂ ਕਾਫੀ ਸਮੇਂ ਤੱਕ ਉਸਨੂੰ ਉਡੀਕਿਆ ਫਿਰ ਜਦੋਂ ਉਹ ਮੇਰੇ ਤੱਕ ਪਹੁੰਚਿਆ ਤਾਂ ਉਹ ਰਿਮੋਟ ਦੇ ਪਿਛਲੇ ਪਾਸੇ ਦਾ ਢੱਕਣ ਨਹੀਂ ਸੀ ਮੈਂ ਉਸ ਦੀ ਰਿਪੋਰਟ ਕੀਤੀ ਕਿ ਇਹ ਰਿਪੋਰਟ ਖਰਾਬ ਹੈ ਉਨ੍ਹਾਂ ਨੇ ਮੈਨੂੰ ਉਸ ਰਿਮੋਟ ਨੂੰ ਵਾਪਸ ਕਰਨ ਬਾਰੇ ਕਿਹਾ ਮੈਂ ਉਸਨੂੰ ਉਸੇ ਤਰ੍ਹਾਂ ਬੰਦ ਕਰਕੇ ਵਾਪਸ ਭੇਜ ਦਿੱਤਾ ਪਰ ਉਹਨਾਂ ਨੇ ਮੈਨੂੰ ਇਹ ਭਰੋਸਾ ਦਿੱਤਾ ਕਿ ਕੁਝ ਦਿਨਾਂ ਵਿੱਚ ਹੀ ਤੁਹਾਡੀ ਰਾਸ਼ੀ ਤੁਹਾਡੇ ਖਾਤੇ ਵਿੱਚ ਆ ਜਾਵੇਗੀ ਪਰ ਅੱਜ ਤਕਰੀਬਨ ਵੀਹ ਪੱਚੀ ਦਿਨ ਹੋ ਚੁੱਕੇ ਹਨ ਅਜੇ ਤੱਕ ਮੇਰੀ ਰਾਸ਼ੀ ਮੇਰੇ ਅਕਾਊਂਟ ਖਾਤੇ ਵਿੱਚ ਨਹੀਂ ਵਾਪਸ ਆਈ ਮੈਂ ਉਹਨਾਂ ਨੂੰ ਫਿਰ ਇੱਕ ਵਾਰ ਬੇਨਤੀ ਕਰ ਕੀਤੀ ਕਿ ਮੇਰੀ ਰਾਸ਼ੀ ਜਲਦੀ ਤੋਂ ਜਲਦੀ ਮੈਨੂੰ ਭੇਜ ਦਿਓ ਤਾਂ ਕਿ ਮੈਂ ਉਸ ਰਿਮੋਟ ਦੀ ਥਾਂ ਨਵੇਂ ਰਿਮੋਟ ਨੂੰ ਅਪਲਾਈ ਕਰ ਸਕਾਂ ਅਤੇ ਆਪਣੇ ਹੋਰ ਸਾਥੀਆਂ ਨਾਲ ਇਸਦਾ ਸੰਪਰਕ ਕਰਕੇ ਤੁਹਾਡੀ ਇਹ ਐਡ ਕਰ ਸਕਾਂ ਕਿ ਤੁਹਾਡਾ ਔਨਲਾਈਨ ਸਮਾਨ ਬਹੁਤ ਵਧੀਆ ਹੈ ਧੰਨਵਾਦ